ਪੰਜਾਬ ਦੇ ਵਿੱਚ ਜੇਕਰ ਮੀਡੀਆ ਦੁਆਰਾ ਕਵਰ ਕੀਤੇ ਗਏ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਉਹ ਰਾਜਨੀਤਿਕ ਅਨੇਤਿਆਂ ਦੇ ਬਾਰੇ ਹੁੰਦੇ ਹਨ ਜਿਸ ਦੇ ਵਿੱਚ ਇੱਕ ਨੇਤਾ ਜਾਂ ਇੱਕ ਪੋਲੀਟੀਕਲ ਬੰਦਾ ਦੂਜੇ ਬੰਦੇ ਦੀ ਬੁਰਾਈ ਕਰ ਰਿਹਾ ਹੁੰਦਾ ਹੈ ਜਾਂ ਕਹਿ ਲਓ ਵੀ ਜਿਹੜਾ ਦੂਸਰਾ ਬੰਦਾ ਹੁੰਦਾ ਉਹ ਪਹਿਲੇ ਲੀਡਰ ਦੀ ਦਿੱਤੀ ਗਈ ਤੋਮਸ 'ਤੇ ਜਾਂ ਗੱਲ ਦੇ ਉੱਤੇ ਉਹਨੂੰ ਜਵਾਬ ਦੇ ਰਿਹਾ ਹੁੰਦਾ ਹੈ ਜੋ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਵੇਸਟੇਜ ਅੋਫ ਟਾਈਮ ਹੈ ਸਾਡੇ ਲੀਡਰਜ਼ ਨੂੰ ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ ਇੱਕ ਦੂਸਰੇ ਦੀਆਂ ਵੈਲ ਬਿੰਗਸ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਅਤੇ ਜਿਹੜੀਆਂ ਨੋਨ ਅਕਸੈਪਟੇਬਲ ਚੀਜ਼ਾਂ ਨੇ ਉਹਨਾਂ 'ਤੇ ਜ਼ਰੂਰ ਗੱਲ ਕਰਨੀ ਚਾਹੀਦੀ ਹੈ ਪਰ ਇਹਨਾਂ ਇਹਨਾਂ ਕਹਿ ਲਓ ਲਿਟਰੇਟ ਵੇਅ ਇਨ ਆ ਗੁੱਡ ਵੇਅ ਗੱਲ ਕਰਨੀ ਚਾਹੀਦੀ ਹੈ ਹਰ ਵੇਲੇ ਉਸ ਨੂੰ ਡਬੇਟਬਲ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਜਿਹੜੀ ਕੋਈ ਵੀ ਪਾਰਟੀ ਹੈ ਜਾਂ ਪੋਲੀਟੀਕਲ ਏਜੰਡਾ ਉਹਨਾਂ ਦਾ ਜਿਹੜਾ ਬੇਸਿਕ ਮੁੱਦਾ ਹੈ ਜਾਂ ਪਰਪਸ ਹੈ ਉਹ ਹੀ ਹੋਣਾ ਚਾਹੀਦਾ ਕਿ ਬੈਟਰਮੈਂਟ ਕਿਸ ਤਰੀਕੇ ਨਾਲ ਲਈ ਜਾ ਸਕਦੀ ਹੈ ਅਤੇ ਉਹਨਾਂ ਨੂੰ ਬਜਾਏ ਆਪਣੇ ਹੱਥ ਵਿੱਚ ਪਾਵਰ ਦੀ ਲਾਲਸਾ ਦੇ ਉਹਨਾਂ ਨੂੰ ਬੈਟਰਮੈਂਟ ਲਈ ਮੈਨੂੰ ਲੱਗਦਾ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਮੋਸਟ ਅੋਫ ਦਾ ਟਾਈਮਸ ਜਿਹੜੇ ਲੀਡਰਸ ਨੇ ਜਾਂ ਤਾਂ ਭਾਸ਼ਣ ਦੇਣ ਵਿੱਚ ਜਾਂ ਇੱਕ ਦੂਜੇ ਨੂੰ ਨੀਚਾ ਦਿਖਾਣ ਵਿੱਚ ਹੀ ਲੱਗੇ ਰਹਿੰਦੇ ਨੇ ਤਾਂ ਮੈਨੂੰ ਲੱਗਦਾ ਵੀ ਉਹਨਾਂ ਵਿੱਚ ਹੈਲਦੀ ਕੋਂਪੀਟੇਟਿਵ ਸਪਿਰਿਟ ਹੋਣੀ ਚਾਹੀਦੀ ਹੈ ਜੋ ਸਾਨੂੰ ਸਪੋਰਟਸ ਦੇ ਵਿੱਚ ਵੀ ਸਿਖਾਇਆ ਜਾਂਦਾ ਹੈ ਪਰ ਉਹ ਨਹੀਂ ਹੁੰਦੀ ਅਤੇ ਦੂਸਰੀ ਚੀਜ਼ ਜਿਹੜੀ ਪੋਰਟਰੇਅ ਕੀਤੀ ਜਾਂਦੀ ਹੈ ਮੀਡੀਆ ਦੇ ਵੱਲੋਂ ਉਹ ਮੋਸਟਲੀ ਜਾਂ ਤਾਂ ਕਰਾਈਮਸ ਹੁੰਦੇ ਨੇ ਸਪੋਰਟਸ ਦੇ ਬਾਰੇ ਬਹੁਤ ਮਤਲਬ ਕਹਿ ਲਓ ਵੀ ਛੋਟੇ ਮੋਟੇ ਕਟਸ ਸ਼ੋਅ ਕੀਤੇ ਜਾਂਦੇ ਨੇ ਜਦ ਕੋਈ ਵੀ ਅਚੀਵਮੈਂਟ ਹੁੰਦੀ ਹੈ ਜਾਂ ਨਹੀਂ ਹੁੰਦੀ ਜਾਂ ਹਾਰ ਜਾਂਦੇ ਨੇ ਉਹ ਮੋਸਟਲੀ ਕਰਾਈਮਸ ਦੇ ਬਾਰੇ ਜ਼ਿਆਦਾ ਪੋਟਰੇਅ ਕੀਤਾ ਜਾਂਦਾ ਕਿ ਅੱਜ ਇਹ ਹੋ ਗਿਆ ਇੱਥੇ ਕਿਸੇ ਦਾ ਕਤਲ ਹੋ ਗਿਆ ਇਸ ਨੂੰ ਇਸ ਜਗ੍ਹਾ 'ਤੇ ਚੋਰੀ ਹੋ ਗਈ ਅਤੇ ਮੈਂ ਗੁੰਡਾ ਗਰਦੀ ਦਿਖਾਈ ਗਈ ਮੈਨੂੰ ਲੱਗਦਾ ਵੀ ਇਹਨਾਂ ਚੀਜ਼ਾਂ ਦੇ ਇਹਨਾਂ ਚੀਜ਼ਾਂ ਦਾ ਜਿਹੜਾ ਪਰਪਸ ਹੈ ਦਿਖਾਉਣ ਦਾ ਉਹ ਸਿਰਫ ਅਵੇਅਰਨੈਂਸ ਫੈਲਾਉਣਾ ਹੋਣਾ ਚਾਹੀਦਾ ਨਾ ਕਿ ਨੈਗੇਟਿਵੀਟੀ ਫੈਲਾਉਣਾ ਹਰ ਟਾਈਮ ਵੀਡੀਓ ਕਲਿਪਸ ਇੰਨੀਆਂ ਜ਼ਿਆਦਾ ਵਰਨਰੇਬਲ ਵੀਡੀਓ ਕਲਿਪਸ ਨੂੰ ਨਿਊਜ਼ ਚੈਨਲ 'ਤੇ ਸ਼ੋਅ ਕੀਤਾ ਜਾਂਦਾ ਹੈ ਕਿ ਜੇਕਰ ਬੱਚੇ ਨਿਊਜ਼ ਚੈਨਲਸ ਦੇਖਣ ਮੈਨੂੰ ਲੱਗਦਾ ਤਾਂ ਉਹਨਾਂ ਨੂੰ ਨੌੌਲੇਜ ਤੋਂ ਜ਼ਿਆਦਾ ਤਾਂ ਨੈਗੇਟਿਵਿਟੀ ਮਿਲਦੀ ਹੈ ਬੰਦਾ ਬਹੁਤ ਜ਼ਿਆਦਾ ਡਿਪਰੈਸਡ ਫੀਲ ਕਰਦਾ ਹੈ ਤਾਂ ਅਵੇਅਰਨੈਸ ਫੈਲਾਉਣਾ ਜਿਹੜਾ ਹੈ ਨਿਊਜ਼ ਚੈਨਲਸ ਵਾਲਿਆਂ ਦਾ ਪਰਪਸ ਹੋਣਾ ਚਾਹੀਦਾ ਨਾ ਕਿ ਸਿਰਫ ਸ਼ੋਅ ਟਾਈਮ ਖੱਟਣਾ ਉਹਨਾਂ ਦਾ ਮੁੱਦਾ ਹੋਣਾ ਚਾਹੀਦਾ ਹੈ ਅਤੇ ਇਸ ਤੋਂ ਇਲਾਵਾ ਟੂਰਿਜ਼ਮ ਦੇ ਬਾਰੇ ਕੁਛ ਕਟਸ ਅਤੇ ਸ਼ੋਰਟ ਕਲਿਪਸ ਹੁੰਦੀਆਂ ਨੇ ਕੁਛ ਸ਼ੋਜ ਦੀਆਂ ਜੋ ਦਿਖਾਈਆਂ ਜਾਂਦੀਆਂ ਨੇ ਉਹ ਵਧੀਆ ਲੱਗਦੀਆਂ ਨੇ ਤਾਂ ਮੈਨੂੰ ਲੱਗਦਾ ਮੀਡੀਆ ਨੂੰ ਬਹੁਤ ਚੀਜ਼ਾਂ ਕਹਿੰਦੇ ਨੇ ਵੀ ਜਿਹੜੀ ਕੰਟਰੀ ਦੀ ਹੈ ਸਿਟੀ ਦੀ ਮੀਡੀਆ ਪੋਜੀਟਿਵਿਟੀ ਜ਼ਿਆਦਾ ਸ਼ੋਅ ਕਰਦੀ ਹੈ ਤਾਂ ਉਹ ਆਪਣੇ ਆਪ ਇਮਪੈਕਟ ਪੋਜੀਟਿਵ ਲੈ ਕੇ ਆਉਂਦੀ ਹੈ ਤਾਂ ਮੀਡੀਆ ਨੂੰ ਬਹੁਤ ਸਾਰੀਆਂ ਪੋਜੀਟਿਵ ਸਾਈਡਸ ਵੀ ਸ਼ੋਅ ਕਰਨੀਆਂ ਚਾਹੀਦੀਆਂ ਨੇ ਜ਼ਿਆਦਾ ਸ਼ੋਅ ਕਰਨੀਆਂ ਚਾਹੀਦੀਆਂ ਨੇ ਨੈਗੇਟਿਵਿਟੀ ਘੱਟ ਸ਼ੋਅ ਕਰਨੀ ਚਾਹੀਦੀ ਹੈ ਅਵੇਅਰਨੈਸ ਫੈਲਾਉਣੀ ਜਿੱਥੇ ਜ਼ਰੂਰੀ ਹੈ ਜ਼ਰੂਰ ਉਹ ਵਾਲੇ ਪੁਆਇੰਟਸ ਲੋਕਾਂ ਨੂੰ ਦੱਸੋ ਅਵੇਅਰਨੈਸ ਫੈਲਾਓ ਪਰ ਪੋਜੀਟਿਵਿਟੀ ਜ਼ਰੂਰ ਫੈਲਾਓ